ਸਤਿ ਸ਼੍ਰੀ ਅਕਾਲ ਸ਼੍ਰੀਮਾਨ ਜੀ ਮੇਰਾ ਨਾਮ ਰਜਨਦੀਪ ਕੌਰ ਹੈ ਮੈਂ ਮਿਤੀ ਪੱਚੀ ਪੰਜ ਦੋ ਹਜ਼ਾਰ ਚੌਵੀ ਨੂੰ ਓਲਾ ਕੈਬਸ ਦੇ ਮਾਧਿਅਮ ਰਾਹੀਂ ਬਠਿੰਡਾ ਤੋਂ ਅੰਮ੍ਰਿਤਸਰ ਲਈ ਇੱਕ ਕੈਬ ਬੁੱਕ ਕੀਤੀ ਸੀ ਜਿਸ ਨੇ ਮੈਨੂੰ ਅੰਮ੍ਰਿਸਤਰ ਦਸ ਵਜੇ ਤੱਕ ਪਹੁੰਚਾਉਣ ਦਾ ਦਾਅਵਾ ਕੀਤਾ ਸੀ ਕਿਉਂਕਿ ਗਿਆਰਾਂ ਵਜੇ ਮੈਂ ਆਪਣੇ ਪੇਪਰ ਸਥਾਨ ਉੱਪਰ ਪਹੁੰਚਣਾ ਸੀ ਪਰ ਪੇਪਰ ਸੈਂਟਰ ਵੱਲੋਂ ਸਮੇਂ ਵਿੱਚ ਕੁਛ ਤਬਦੀਲੀ ਕਰ ਦਿੱਤੀ ਗਈ ਹੈ ਜਿਸ ਕਰਕੇ ਮੈਨੂੰ ਉੱਥੇ ਨੌਂ ਵਜੇ ਪਹੁੰਚਣਾ ਪਵੇਗਾ ਮੇਰੇ ਦੁਆਰਾ ਬੁੱਕ ਕੀਤੀ ਗਈ ਇਹ ਕੈਬ ਮੈਨੂੰ ਉੱਥੇ ਦੇਰੀ ਨਾਲ ਪਹੁੰਚਾਵੇਗੀ ਇਸ ਕਰਕੇ ਮੈਂ ਇਸ ਨੂੰ ਰੱਦ ਕਰਨਾ ਚਾਹੁੰਦੀ ਹਾਂ ਅਤੇ ਕੋਈ ਹੋਰ ਕੈਬ ਬੁੱਕ ਕਰ ਰਹੀ ਹਾਂ ਜੋ ਮੈਨੂੰ ਮੇਰੇ ਪੇਪਰ ਸਥਾਨ ਉੱਪਰ ਸਹੀ ਸਮੇਂ ਉੱਪਰ ਪਹੁੰਚਾ ਦੇਵੇਗੀ ਪਰ ਜੇਕਰ ਤੁਸੀਂ ਮੈਨੂੰ ਇਸ ਕੈਬ ਰਾਹੀਂ ਸਹੀ ਸਮੇਂ ਉੱਤੇ ਪਹੁੰਚਾਉਣ ਵਿੱਚ ਸਮਰੱਥ ਹੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ